ਪੰਜਾਬ ਦਾ ਭੂਗੋਲ ਰਾਜ ਦੋਲਤ ਅਤੇ ਮੌਕਿਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਜਿਵੇਂ ਅੱਜ ਕੱਲ੍ਹ ਦੇ ਮਨੁੱਖ ਆਪਣੇ ਖੇਤਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਉਗਾਉਂਦੇ ਹਨ ਜਿਵੇਂ ਕਿ ਕਣਕ ਚੌਲ ਬਾਜਰਾ ਫਿਰ ਉਹਨੂੰ ਇੱਕ ਦੂਜੇ ਨੂੰ ਇੱਕ ਦੂਜੇ ਦੇ ਦੇਸ਼ਾਂ ਦੇ ਵਿੱਚ ਉਹਨੂੰ ਟਰੇਡ ਦੇ ਥਰੂ ਵੰਡਿਆ ਜਾਂਦਾ ਹੈ ਐਕਸਪੋਰਟ ਇੰਪੋਰਟ ਕੀਤਾ ਜਾਂਦਾ ਹੈ ਜਿਹਦੇ ਨਾਲ ਸਾਡੀ ਦੂਸਰੇ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਵੀ ਵੱਧਦੀ ਹੈ ਅਤੇ ਜੋਬ ਦੀਆਂ ਓਪੋਰਚਨਿਟੀਜ ਵੀ ਬਹੁਤ ਵਧਦੀਆਂ ਹਨ ਜਿਹਦੇ ਨਾਲ ਲੋਕ ਵੱਧ ਤੋਂ ਵੱਧ ਚੀਜ਼ਾਂ ਉਗਾਉਂਦੇ ਹਨ ਅਤੇ ਆਪਣੇ ਦੇਸ਼ ਦੀ ਆਰਥਿਕ ਸਥਿਤੀ ਦੇ ਵਿੱਚ ਵੀ ਬਹੁਤ ਵਾਧਾ ਹੁੰਦਾ ਹੈ ਇਹ ਇੱਕ ਬਹੁਤ ਚੰਗੀ ਚੀਜ਼ ਹੈ ਜਿਹੜੀ ਪੰਜਾਬ ਦੇ ਭੂਗੋਲ ਰਾਜ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਂਦੀ ਹੈ ਅੱਜ ਕੱਲ੍ਹ ਦੇ ਕਿਸਾਨ ਜਿਹੜੇ ਨੇ ਬਹੁਤ ਇੱਕ ਕਿਫਾਇਤੀ ਮੰਦ ਇਨਸਾਨ ਹਨ ਅੱਜ ਕੱਲ੍ਹ ਦੇ ਦੇਸ਼ ਦੇ ਉਹਨਾਂ ਤੋਂ ਬਿਨ੍ਹਾਂ ਅਸੀਂ ਸਰਵਾਈਵ ਵੀ ਨਹੀਂ ਕਰ ਸਕਦੇ ਉਹ ਟ੍ਰਾਂਸਪੋਰਟ ਸਿਸਟਮ ਦੇ ਵਿੱਚ ਵੀ ਬਹੁਤ ਵਾਧਾ ਕਰਦੇ ਹਨ